ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਹੋਰ ਸਿਹਤਾਂ ਕਿੱਦਾਂ ਜੀ ਚਲੋ ਠੀਕ ਹੀ ਚਾਹੀਦੀ ਵੈਸੇ ਨਾ ਇੱਕ ਗੱਲ ਆ ਬਾਹਰ ਤਾਂ ਮੈਨੂੰ ਵੀ ਚੰਗਾ ਨਹੀਂ ਲੱਗਦਾ ਆਪਣੇ ਬੱਚੇ ਆਪਣੇ ਪੰਜਾਬ ਵਿੱਚ ਹੀ ਰਹਿਣ ਨਾ ਤਾਂ ਚੰਗੇ ਲੱਗਦੇ ਆ ਜਿਹੜਾ ਜਿਹੜਾ ਉਹ ਬਾਹਰ ਹੀ ਜਾਂਦਾ ਜੀ ਕਿਉ ਇਹ ਕਿਉਂ ਜਾਂਦਾ ਇਹ ਪਤਾ ਕਰਨਾ ਅਖਬਾਰ ਤਾਂ ਪੜ੍ਹ ਕੇ ਵੇਖਣਾ ਚਾਹੀਦਾ ਵਾ ਬਾਹਰ ਜਾਣਾ ਨਹੀਂ ਚਾਹੀਦਾ ਬੱਚਿਆਂ ਨੂੰ ਪੰਜਾਬ ਵਰਗੀ ਕੋਈ ਚੀਜ਼ ਨਹੀਂ ਹੈ ਠੀਕ ਹੈ ਭਾਅ ਜੀ ਬਿਲਕੁਲ ਮੈਂ ਵੀ ਇਹੀ ਚਾਹੁੰਦੀ ਹਾਂ ਕਿ ਬੱਚੇ ਆਪਣੇ ਇੱਥੇ ਰਹਿਣ ਪੰਜਾਬ 'ਚ ਰਹਿਣ ਪੰਜਾਬ ਵਰਗੀ ਕੋਈ ਚੀਜ਼ ਵੀ ਨਹੀਂ ਹੈਗੀ ਬਾਹਰ ਲੋਕ ਤੁਰੀ ਜਾਂਦੇ ਤੁਰੀ ਜਾਂਦੇ ਬਾਹਰ ਕੁਛ ਨਹੀਂ ਪਿਆ ਕਦੇ ਕਿਤੇ ਚਲੇ ਜਾਂਦੇ ਕਦੇ ਕਿਤੇ ਬਾਹਰ ਚਲ ਜਾਂਦੇ ਆ ਜਾਣਾ ਹੀ ਨਹੀਂ ਚਾਹੀਦਾ ਅਤੇ ਇਸ ਵਾਸਤੇ ਮੈਂ ਹਾਂਜੀ ਹਾਂ ਉੱਥੇ ਉੱਥੇ ਆਹ ਚੀਜ਼ਾਂ ਨਹੀਂ ਨਾ ਮਿਲਦੀਆਂ ਬਾਹਰ ਨਹੀਂ ਮਿਲਦੀਆਂ ਪੰਜਾਬ 'ਚ ਮਿਲਦੀਆਂ ਨਾ ਇਹ ਚਾਹੀਦਾ ਵੈਸੇ ਬੱਚਿਆਂ ਨੂੰ ਮਾਂ ਪਿਓ ਨੂੰ ਵੀ ਰੋਕਣਾ ਚਾਹੀਦਾ ਬਾਹਰ ਨਹੀਂ ਜਾਣਾ ਚਾਹੀਦਾ ਬਾਹਰ ਤਾਂ ਕੁਛ ਪਿਆ ਹੀ ਨਹੀਂ ਨਾ ਹੋਇਆ ਜੋ ਪੰਜਾਬ 'ਚ ਆ ਉਹ ਉੱਥੇ ਬਾਹਰ ਕੁਛ ਨਹੀਂ ਹੈ ਹਾਂਜੀ ਭਾਅ ਜੀ ਹੋਰ ਠੀਕ ਚਲੋ ਠੀਕ ਹੈ ਜੀ ਠੀਕ ਹੈ ਓਕੇ ਓਕੇ